ਮੇਰੇ ਘਰ ਵਿੱਚ ਚਾਰ ਜਣੇ ਨੇ ਸਭ ਨੂੰ ਚਾਹ ਬਹੁਤ ਪਸੰਦ ਹੈ ਔਰ ਸਭ ਆਪਣੀ ਆਪਣੀ ਪਸੰਦ ਦੀ ਚਾਹ ਪੀਂਦੇ ਹਨ ਕੋਈ ਗਰੀਨ ਟੀ ਪੀਂਦਾ ਕੋਈ ਬਲੈਕ ਟੀ ਪੀਂਦਾ ਵਾ ਔਰ ਮੇਰੇ ਪਾਪਾ ਮੇਰੇ ਹੱਥ ਦੀ ਚਾਹ ਪੀਂਦੇ ਨੇ ਉਹਨਾਂ ਨੂੰ ਮੇਰੇ ਹੱਥ ਦੀ ਚਾਹ ਬਹੁਤ ਪਸੰਦ ਹੈ ਅਤੇ ਮੈਂ ਆਪਣੀ ਚਾਹ ਦੀ ਰੇਸਿਪੀ ਦੱਸਾਂਗੀ ਹੁਣ ਕਿੱਦਾਂ ਬਣਾਉਂਦੀ ਆ ਮੈਂ ਮੈਂ ਆਪਣੀ ਚਾਹ ਵਿੱਚ ਸਭ ਤੋਂ ਪਹਿਲਾਂ ਪਾਣੀ ਲੈਂਦੀ ਹਾਂ ਔਰ ਉਸਨੂੰ ਗੈਸ 'ਤੇ ਰੱਖਦੀ ਆ ਫਿਰ ਪਾਣੀ ਦੇ ਵਿੱਚ ਮੈਂ ਇਲਾਇਚੀ ਪਾਉਂਦੀ ਹਾਂ ਪੱਤੀ ਪਾਉਂਦੀ ਹਾਂ ਚੀਨੀ ਪਾਉਂਦੀ ਹਾਂ ਉਸਨੂੰ ਫਿਰ ਪੰਜ ਮਿੰਟ ਉਬਾਲ ਦਵਾ ਕੇ ਫਿਰ ਉਹਦੇ ਵਿੱਚ ਮੈਂ ਦੁੱਧ ਪਾਉਂਦੀ ਹਾਂ ਉਹਨੂੰ ਪਾਣੀ ਦੀ ਕੁਆਨਟਿਟੀ ਥੋੜ੍ਹੀ ਘੱਟ ਰੱਖਦੀ ਹਾਂ ਦੁੱਧ ਨਾਲੋਂ ਅਤੇ ਉਹ ਚਾਹ ਜਦੋਂ ਉਬਾਲਾ ਆਉਂਦਾ ਵਾ ਦੋ ਤਿੰਨ ਵਾਰ ਉਬਾਲਾ ਦਵਾ ਕੇ ਉਸਨੂੰ ਮੈਂ ਪੁਣ ਲੈਂਦੀ ਹਾਂ ਅਤੇ ਉਹ ਚਾਹ ਇੰਨੀ ਸੁਆਦ ਬਣਦੀ ਆ ਕਿ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਪਸੰਦ ਹੈ ਮੇਰੇ ਹੱਥ ਦੀ ਚਾਹ ਔਰ ਮੇਰੇ ਮੰਮਾ ਨੂੰ ਤਾਂ ਹੈ ਹੀ ਪਰ ਉਹ ਜ਼ਿਆਦਾਤਰ ਗਰੀਨ ਟੀ ਹੀ ਪੀਂਦੇ ਆ ਔਰ ਮੇਰਾ ਭਰਾ ਜਿਹੜਾ ਹੈਗਾ ਉਹ ਬਲੈਕ ਟੀ ਪੀਂਦਾ ਵਾ ਕਿਉਂਕਿ ਉਹ ਜਿਮ ਜਾਂਦਾ ਵਾ ਉਸਨੂੰ ਡਾਇਟਿੰਗ ਵਗੈਰਾ ਜ਼ਿਆਦਾ ਪਸੰਦ ਹੈ ਤਾਂ ਉਹ ਇਹ ਵਾਲੀ ਚਾਹ ਨਹੀ ਪੀਂਦਾ